ਹਾਂਜੀ ਮੈਂ ਨਾ ਆਪਣਾ ਸ਼ਿਵ ਸ਼ਕਤੀ ਤੋਂ ਕੋਈ ਸਮਾਨ ਮੰਗਵਾਇਆ ਸੀਗਾ ਖਾਣ ਪੀਣੇ ਵਾਲਾ ਸ਼ਾਹੀ ਪਨੀਰ ਅਰ ਕੜਾਹੀ ਚਿਕਨ ਪਰ ਉਹਦੇ ਵਿੱਚ ਕੀ ਦੇਖਿਆ ਕਿ ਜਦੋਂ ਮੇਰੇ ਕੋਲ ਔਡਰ ਆਇਆ ਇਹ ਉਹ ਟ੍ਰਾਂਸਪੇਰੈਂਟ ਗਲਾਸ ਹੋਣ ਕਰਕੇ ਜਿਹਦੇ ਵਿੱਚ ਉਹਨਾਂ ਨੇ ਖਾਣਾ ਭੇਜਿਆ ਸੀਗਾ ਉਹਦੇ ਵਿੱਚ ਮੈਂ ਦੇਖਿਆ ਉਹਨਾਂ ਨੇ ਜਿਹੜਾ ਸ਼ਾਹੀ ਪਨੀਰ ਸੀਗਾ ਉਹਦੀ ਜਗ੍ਹਾ ਉਹਨਾਂ ਨੇ ਦਾਲ ਭੇਜ ਤੀ ਜੋ ਕਿ ਦਾਲ ਤਾਂ ਮੇਰੇ ਕੋਲ ਪਹਿਲਾਂ ਹੀ ਫ੍ਰਿੱਜ ਵਿੱਚ ਪਈ ਹੈ ਅਤੇ ਮੈਂ ਉਹਨਾਂ ਦਾ ਸ਼ਾਹੀ ਪਨੀਰ ਅਤੇ ਕੜਾਹੀ ਚਿਕਨ ਮੈਂ ਖਾਣਾ ਪਸੰਦ ਕਰਦਾ ਅਤੇ ਇਸ ਕਰਕੇ ਮੈਨੂੰ ਹੁਣ ਉਹ ਆਪਣਾ ਇਹ ਖਾਣਾ ਮੈਂ ਵਾਪਸ ਕਰ ਰਿਹਾ ਉਸ ਤੋਂ ਬਾਅਦ ਮੈਨੂੰ ਇਹ ਉਹਦੀ ਪ੍ਰਕਿਰਿਆ ਕਿਆ ਉਹਦੇ ਬਾਰੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਪਰ ਮੈਂ ਖਾਣਾ ਨਹੀਂ ਰੱਖ ਰਿਹਾ ਕਿਉਂਕਿ ਇਹ ਆਲ ਇਹ ਆਲਰੈਡੀ ਮੇਰੇ ਫਰਿੱਜ ਦੇ ਵਿੱਚ ਪਿਆ ਕ੍ਰਿਪਾ ਕਰਕੇ ਮੇਰਾ ਇਹ ਔਡਰ ਇਹ ਕੈਂਸਲ ਕੀਤਾ ਜਾਵੇ ਅਤੇ ਨਵੇਂ ਸਿਰੇ ਤੋਂ ਮੈਨੂੰ ਤੁਸੀਂ ਦੁਬਾਰਾ ਭੇਜ ਸਕਦੇ ਹੋ ਇਹ ਅਗਰ ਭੇਜ ਸਕਦੇ ਤਾਂ ਮੇਰੇ ਨਾਲ ਇਹ ਇਸੇ ਨੰਬਰ 'ਤੇ ਸੰਪਰਕ ਜ਼ਰੂਰ ਕਰ ਲਿਆ ਜਾਵੇ ਇਹ ਵਾਪਸੀ ਖਾਣਾ ਮੈਂ ਤੁਹਾਨੂੰ ਭੇਜ ਰਿਹਾ ਹਾਂ